ਮੇਰੇ ਲਿਖਣ ਦਾ ਟੀਚਾ ਹੁੰਦਾ ਹੈ ਆਪਣੇ ਆਪ ਨੂੰ ਇੰਪਰੂਵ ਕਰਨਾ ਮੈਂ ਚਾਹੁੰਦਾ ਹਾਂ ਕਿ ਮੈਂ ਅੱਜ ਦੇ ਆਪਣੇ ਦਿਨ ਦੇ ਵਿੱਚ ਅੱਜ ਆਪਣੇ ਪੂਰੇ ਦਿਨ ਦੇ ਵਿੱਚ ਕੀ ਕੀ ਕੀਤਾ ਅਤੇ ਕਿਹੜੀ ਕਿਹੜੀ ਚੀਜ਼ ਮੈਨੂੰ ਕਰਨੀ ਚਾਹੀਦੀ ਸੀ ਅਤੇ ਕਿਹੜੀ ਚੀਜ਼ ਨਹੀਂ ਕਰਨੀ ਚਾਹੀਦੀ ਚਾਹੀਦੀ ਸੀ ਇਨ੍ਹਾਂ ਸਾਰੀਆਂ ਚੀਜ਼ਾਂ ਵਾਂ ਨੂੰ ਲਿਖ ਕੇ ਮੈਂ ਆਪਣੇ ਆਪ ਨੂੰ ਕੱਲ੍ਹ ਨਾਲੋਂ ਇੰਪਰੂਵ ਕਰਦਾ ਹਾਂ ਜਿਸ ਰਾਹੀਂ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਕੀ ਅੱਜ ਮੈਂ ਜਿਹੜੀ ਅੱਜ ਮੈਂ ਆਪਣੇ ਆਪ ਵਧੀਆ ਕੁਛ ਕਿਹੜੀ ਵਧੀਆ ਚੀਜ਼ ਕੀਤੀ ਹੈ ਅਤੇ ਕਿਹੜੀ ਚੀਜ਼ ਮੈਂ ਗਲਤ ਕੀਤੀ ਹੈ ਉਸ ਰਾਹੀਂ ਮੈਂ ਆਪਣੇ ਵਿਚਾਰਾਂ ਨੂੰ ਸਮਝਦਾ ਹਾਂ ਮੈਂ ਪੂਰੇ ਦਿਨ ਦੇ ਵਿੱਚ ਕੀ ਕੀ ਕੀਤਾ ਮੈਂ ਉਸ ਚੀਜ਼ ਨੂੰ ਸਮਝਦਾ ਹਾਂ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਹੀ ਮੈਂ ਹੋਰ ਕਲੈਅਰਟੀ ਹੋਰ ਕਲੀਐਰਟੀ ਕਲੀਅਰ ਹੁੰਦਾ ਹਾਂ ਅਤੇ ਇਹ ਸਾਰੀਆਂ ਚੀਜ਼ਾਂ ਕਰਨ ਦਾ ਮੇਰਾ ਮਕਸਦ ਹੁੰਦਾ ਹੈ ਕਿ ਮੈਨੂੰ ਇਨ੍ਹਾਂ ਚੀਜ਼ਾਂ ਬਾਰੇ ਹੋਰ ਕਲੀਐਰਟੀ